ਇੱਥੇ ਬਹੁਤ ਸਾਰੇ ਧਰਮਾਂ ਦੇ ਲੋਕ ਰਹਿੰਦੇ ਹਨ ਜਿਨ੍ਹਾਂ ਦੇ ਵੱਖ ਵੱਖ ਧਰਮਾਂ ਅਤੇ ਸੱਭਿਆਚਾਰ ਹੈ ਇਹਨਾਂ ਲੋਕਾਂ ਦੇ ਧਰਮ ਅਤੇ ਤਿਉਹਾਰ ਵੱਖ ਵੱਖ ਹੋਣ ਕਰਕੇ ਖਾਣ ਪੀਣ ਦੀਆਂ ਚੀਜ਼ਾਂ ਵੀ ਵੱਖੋ ਵੱਖ ਹਨ ਜਿਵੇਂ ਕਿ ਸਾਡੇ ਇੱਥੇ ਰੱਖੜੀ ਵਾਲੇ ਦਿਨ ਖੀਰ ਜ਼ਿਆਦਾ ਬਣਾਈ ਜਾਂਦੀ ਹੈ ਦਿਵਾਲੀ ਵੱਡਾ ਤਿਉਹਾਰ ਹੋਣ ਕਰਕੇ ਆਮ ਹਰ ਵਰਗ ਦਾ ਵਿਅਕਤੀ ਇਸ ਨੂੰ ਮਨਾਉਂਦਾ ਹੈ ਅਤੇ ਆਪੋ ਆਪਣੇ ਘਰਾਂ ਵਿੱਚ ਮਠਿਆਈ ਬਣਾਉਂਦਾ ਹੈ ਜਿਵੇਂ ਕਿ ਦੁੱਧ ਪੇੜੇ ਗੁਲਾਬ ਜਾਮੁਨ ਕਰੰਜੀਆਂ ਖੋਏ ਵਾਲੀ ਬਰਫੀ ਨਮਕੀਨ ਮਠਰੀਆਂ ਸ਼ਕਰਪਾਰੇ ਆਦਿ ਮੁਸਲਮਾਨ ਈਦ ਵਾਲੇ ਦਿਨ ਸੇਵੀਆਂ ਬਣਾਉਂਦੇ ਹਨ ਹਿੰਦੂ ਲੋਕ ਗਣੇਸ਼ ਪੂਜਾ ਕਰਨ ਲਈ ਮੋਦਕ ਬਣਾਉਂਦੇ ਹਨ ਅਤੇ ਇਹ ਘਰ ਹੀ ਬਣਾਉਂਦੇ ਹਨ ਕਿਉਂਕਿ ਗਣੇਸ਼ ਜੀ ਨੂੰ ਮੋਦਕ ਬਹੁਤ ਹੀ ਵਧੀਆ ਲੱਗਦੇ ਸਨ ਇਸ ਤਰ੍ਹਾਂ ਹੀ ਬਹੁਤ ਸਾਰੇ ਪਕਵਾਨ ਅਲੱਗ ਅਲੱਗ ਤਿਉਹਾਰਾਂ ਉੱਤੇ ਲੋਕਾਂ ਵੱਲੋਂ ਬਣਾਏ ਜਾਂਦੇ ਹਨ